ਜਿਹੜਾ ਪੰਜਾਬ ਵਿੱਚ ਹੈਗਾ ਹੈ ਸਾਡੇ ਸਿੱਖ ਧਰਮ ਮੰਨਿਆ ਜਾਂਦਾ ਹੈਗਾ ਹੈ ਇਹਦੀਆਂ ਮੁੱਖ ਸਿੱਖਿਆਵਾਂ ਇਹੀ ਹੈਗੀਆਂ ਵੀ ਪ੍ਰਮਾਤਮਾ ਇੱਕ ਹੈ ਇੱਕ 'ਚ ਹੀ ਵਿਸ਼ਵਾਸ਼ ਕਰਨਾ ਹੈਗਾ ਹੈ ਅਤੇ ਜਿਹੜਾ ਸਾਡੇ ਜਿੱਦਾਂ ਪਹਿਲੇ ਗੁਰੂ ਹੈਗੇ ਉਹਨਾਂ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ ਇੱਥੇ ਮਤਲਬ ਪੰਜਾਬ 'ਚ ਜਿਹੜਾ ਕੁਛ ਵੀ ਹੁੰਦੇ ਹੈਗੇ ਜਿਹੜੇ ਬਾਹਰ ਵੀ ਕੋਈ ਮਤਲਬ ਦੇਸ਼ 'ਚ ਜਾਂ ਵਿਦੇਸ਼ਾਂ 'ਚ ਕਿਤੇ ਵੀ ਹੁੰਦਾ ਹੈਗਾ ਕੁਛ ਵੀ ਹੁੰਦਾ ਹੈਗਾ ਹੈ ਉੱਥੇ ਮਤਲਬ ਸੇਵਾ ਕਰਨ ਵਾਸਤੇ ਪੰਜਾਬ ਵਾਲੇ ਪੁੱਜ ਜਾਂਦੇ ਹੈਗੇ ਹੈ ਅਤੇ ਇਹ ਇੱਥੇ ਸੇਵਾ ਅਤੇ ਬਾਅਦ ਕੁਰਬਾਨੀਆਂ ਦੇਣ ਨੂੰ ਵੀ ਬਹੁਤ ਜ਼ਿਆਦਾ ਅੱਗੇ ਹੈਗੇ ਹੈ ਦਿਆਲੂ ਵੀ ਪੂਰੇ ਹੈਗੇ ਹੈ ਪੰਜਾਬ ਵਾਲੇ